ਹਾਂਜੀ ਮੇਰੀ ਮਨਪਸੰਦ ਥਾਵਾਂ ਜਿਹੜੀਆਂ ਹਨ ਉਹ ਜ਼ਿਆਦਾਤਰ ਪਹਾੜੀ ਇਲਾਕੇ ਵਿੱਚ ਹਨ ਜਿਨ੍ਹਾਂ ਵਿੱਚ ਮੇਨ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖਣ ਯੋਗ ਸ਼ਿਮਲਾ ਸੋਲਨ ਆਦਿ ਇਹ ਥਾਵਾਂ ਹਨ ਜਿਨ੍ਹਾਂ ਤੋਂ ਇਲਾਵਾ ਇਹਨਾਂ ਤੋਂ ਅੱਗੇ ਜਾ ਕੇ ਮਨਾਲੀ ਕਸੌਲ ਆਦਿ ਵਗੈਰਾ ਵੀ ਕਾਫੀ ਜ਼ਿਆਦਾ ਵਧੀਆ ਲਾ ਲੱਗਦੀਆਂ ਹਨ ਮੈਂ ਇਹਨਾਂ ਵਿੱਚ ਹਰ ਸਾਲ ਜਾਂਦਾ ਰਹਿੰਦਾ ਹਾਂ ਤੇ ਇਹਨਾਂ ਦੇ ਵਿੱਚ ਜੋ ਇਨਵਾਇਰਮੈਂਟ ਹੈ ਜੋ ਉੱਥੇ ਦਾ ਰਹਿਣਾ ਸਹਿਣਾ ਹੈ ਓਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਹਰ ਸਾਲ ਇਹਨਾਂ ਵਿੱਚੋਂ ਕਿਸੇ ਇੱਕ ਜਗ੍ਹਾ 'ਤੇ ਜਾ ਕੇ ਟਾਈਮ ਸਪੈਂਡ ਕਰਦਾ ਹਾਂ